ਹਾਂ ਮੈਂ ਸਾਈਬਰ ਕ੍ਰਾਇਮ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਸਾਈਬਰ ਕ੍ਰਾਇਮ ਵੱਧ ਰਿਹਾ ਹੈ ਜਿਵੇਂ ਕਿ ਸੋਸ਼ਲ ਮੀਡੀਆ ਜੋ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਔਰ ਅਤੇ ਆਪਣਾ ਅਕਾਊਂਟ ਪਬਲਿਕ ਰੱਖਦੇ ਹਨ ਹੈਕਰ ਉਹਨਾਂ ਦਾ ਅਕਾਊਂਟ ਹੈਕ ਵੀ ਕਰ ਸਕਦੇ ਅਤੇ ਉਹਨਾਂ ਦਾ ਡਾਟਾ ਚੋਰੀ ਕਰ ਸਕਦਾ ਅਤੇ ਉਸਦੀ ਗਲਤ ਵਰਤੋਂ ਵੀ ਕਰ ਸਕਦੇ ਹੈ ਅਤੇ ਕਈਆਂ ਨਾਲ ਇੱਦਾਂ ਹੋ ਵੀ ਗਿਆ ਹੈ ਕਈ ਲੋਕਾਂ ਨਾਲ ਇੱਦਾਂ ਹੋ ਵੀ ਗਿਆ ਹੈ ਉਹਨਾਂ ਦੀਆਂ ਪੋਸਟਾਂ ਜਾ ਫੋਟੋਆਂ ਵਗੈਰਾ ਚੁੱਕ ਕੇ ਜਾਂ ਉਹਨਾਂ ਦਾ ਅਕਾਊਂਟ ਹੈਕ ਕਰਕੇ ਉਹਨਾਂ ਦੀਆਂ ਉਹਨਾਂ ਦਾ ਗਲਤ ਉਹਨਾਂ ਦੀ ਗਲਤ ਵਰਤੋਂ ਕਰ ਸਕਦਾ ਜਿੰਨ੍ਹਾਂ ਕਾਰਣ ਉਹ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਕਈ ਲੋ ਕਈ ਹੈਕਰ ਤਾਂ ਲੋਕਾਂ ਨੂੰ ਕੋਲ ਕਰਕੇ ਉਹਨਾਂ ਨੂੰ ਉਕਸਾਉਂਦੇ ਹਨ ਕਿ ਤੁਹਾਡੀ ਬਹੁਤ ਲੋਟਰੀ ਲੱਗੀ ਆ ਜਾਂ ਸਾਨੂੰ ਪੰਜਾਹ ਲੱਖ ਰੁਪਈਆ ਮਿਲ ਸਕਦਾ ਹੈ ਅਤੇ ਜੋ ਵੀ ਉਹਨਾਂ ਦੇ ਫੋਨ ਉੱਪਰ ਓ ਟੀ ਪੀ ਆਇਆ ਉਹ ਉਹਨਾਂ ਨੂੰ ਸੈਂਡ ਕਰ ਦਿੱਤਾ ਜਾਵੇ ਜਿਸ ਨਾਲ ਤੁਹਾਡੇ ਅਕਾਊਂਟ ਵਿੱਚ ਪੈਸੇ ਆ ਸਕਦੇ ਹਨ ਅਤੇ ਕਈ ਲੋਕ ਉਹਨਾ ਹੈਕਰਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਨੂੰ ਓ ਟੀ ਪੀ ਦੱਸ ਦਿੰਦੇ ਹਨ ਜਿਸ ਕਾਰਣ ਉਹਨਾਂ ਉਹਨਾਂ ਦੇ ਖ਼ਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਹ ਕੱਟੇ ਜਾ ਸਕਦੇ ਆ ਜਾਂ ਉਹਨਾਂ ਦਾ ਅਕਾਊਂਟ ਹੈਕ ਹੋ ਸਕਦਾ ਹੈ ਸਾਨੂੰ ਕਿਸੇ ਨਾਲ ਵੀ ਆਪਣੀ ਬੈਂਕ ਡਿਟੇਲ ਜਾਂ ਓ ਟੀ ਪੀ ਸ਼ੇਅਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਾਨੂੰ ਹੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਸਕਦੀ ਹੈ